ਵਾਤਾਵਰਨ ਦੀ ਗਿਰਾਵਟ ਦਾ ਸਭ ਤੋਂ ਜ਼ਿਆਦਾ ਯੋਗਦਾਨ ਪਿੰਡਾਂ ਦੇ ਵਿੱਚ ਪਾਇਆ ਗਿਆ ਹੈ ਜਿਸ ਕਰਕੇ ਮੀਂਹ ਕਣੀ ਦੇ ਮੌਸਮ ਦੇ ਵਿੱਚ ਛੱਪੜਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਉਹ ਪਾਣੀ ਸੜਕਾਂ 'ਤੇ ਆ ਜਾਂਦਾ ਸੜਕਾਂ ਦੇ ਉੱਤੇ ਪਾਣੀ ਭਰ ਜਾਂਦਾ ਹੈ ਮੱਖੀ ਮੱਛਰ ਪੈਦਾ ਹੁੰਦਾ ਹੈ ਜਿਸ ਦੇ ਨਾਲ ਬਿਮਾਰੀਆਂ ਬਿਮਾਰੀਆਂ ਫੈਲਦੀਆਂ ਹਨ ਜਿਸ ਤੋਂ ਪੇਂਡੂ ਤਬਕੇ ਦਾ ਬੰਦਾ ਬਹੁਤ ਪਰੇਸ਼ਾਨ ਰਹਿੰਦਾ ਹੈ ਉਹਨਾਂ ਦਾ ਪਰਿਵਾਰ ਪਰੇਸ਼ਾਨ ਰਹਿੰਦਾ ਹੈ